ਹੈਲੋ ਹਾਂਜੀ ਮੈਂ ਸੰਦੀਪ ਬੋਲਦੀ ਸੀ ਵੈਸੇ ਹੋਰ ਠੀਕ ਹੋ ਹਾਂਜੀ ਹਾਂਜੀ ਹਾਂਜੀ ਵਧੀਆ ਜੀ ਬਸ ਮੈਂ ਥੋੜ੍ਹਾ ਲਿਖਣ ਦੀ ਕੋਸ਼ਿਸ਼ ਕਰ ਰਹੀ ਸੀਗੀ ਮੈਂ ਮੈਂ ਲਿਖਣ ਲਿਖਣ 'ਚ ਦਿੱਕਤ ਆਉਂਦੀ ਸੀਗੀ ਮੈਂ ਕਿਹਾ ਮੈਂ ਚੱਲ ਗੱਲ ਕਰ ਲੈਂਦੀ ਥੋੜ੍ਹਾ ਟਿਪ ਲੈ ਲੈਂਦੀ ਵੀ ਕਿਵੇਂ ਲਿਖਣਾ ਚਾਹੀਦਾ ਹੈਗਾ ਕਵਿਤਾ ਕਵਿਤਾ ਕਵਿਤਾ ਕਵਿਤਾ ਲਿਖ ਰਹੀ ਕਵਿਤਾ ਹੂੰ ਹਾਂ ਲਾਇਨ ਨਹੀਂ ਲਾਇਨ ਬਣ ਨਹੀਂ ਰਹੀ ਹਾਂ ਕ ਕਵਿਤਾ ਤਾਂ ਮੈਂ ਭਗਤੀ 'ਤੇ ਲਿਖ ਰਹੀ ਸੀ ਹੂੰ ਹੂੰ

ਹੂੰ ਹੂੰ ਹੂੰ ਅੱਛਾ ਠੀਕ ਹੈ ਹੂੰ ਹੂੰ ਹੂੰ ਹੂੰ ਹੂੰ ਹੂੰ ਹੂੰ ਹੂੰ ਠੀਕ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ

ਲਿਖਣ ਦੀ ਕੋਸ਼ਿਸ਼ ਕਰ ਰਹੀ ਸੀ ਹਾਂ ਉਹ ਥੋੜ੍ਹੀ ਤਿੰਨ ਚਾਰ ਲਾਈਨਾਂ ਲਿਖੀਆਂ ਮੈਂ ਥੋੜ੍ਹਾ ਥੋੜ੍ਹਾ ਕੰਫਿਊਜ ਥੋੜ੍ਹੀ ਜਿਹੀ ਹੋਈ ਜਾਂਦੀ ਸੀ ਕੰਫਊਜਨ ਮੈਂ ਕਿਹਾ ਚੱਲ ਮੈਂ ਗੱਲ ਕਰਲਾਂ ਆਪਣੇ ਫਰੈਂਡ ਨਾਲ ਅਤੇ ਮਤਲਬ ਸ਼ਾਇਦ ਮਤਲਬ ਮੈਨੂੰ ਸਹੀ ਮਿਲ ਜਾਵੇ ਹੂੰ ਹੂੰ

ਡਿਸਟਰ ਹੋ ਡਿਸਟਰਬੈਂਸ ਜਿਹੀ ਹੋਈ ਜਾਂਦੀ ਇਸ ਕਰਕੇ ਵੀ ਨਹੀਂ ਥੋੜ੍ਹਾ ਜਿਹਾ ਲਿਖਿਆ ਜਾ ਰਿਹਾ ਸੀ ਤਾਂ ਕਰਕੇ ਅਤੇ

ਚੱਲੋ ਹਾਂਜੀ ਹਾਂਜੀ ਚੱਲੋ ਕੋਈ ਗੱਲ ਨਹੀਂ ਠੀਕ ਹੈ ਮੈਮ ਠੀਕ ਹੈ ਥੋੜ੍ਹਾ ਜਿਹਾ ਲਿਆ ਕੇ ਕਈ ਵਾਰ ਚੱਲੋ ਠੀਕ ਹੈ ਬਹੁਤ ਬਹੁਤ ਥੈਂਕਿ ਊ ਠੀਕ ਹੈ ਕੋਈ ਨਹੀਂ ਠੀਕ ਹੈ ਠੀਕ ਹੈ ਥੈਂਕਿ ਊ